ਹਾਂਜੀ ਰੋਪੜ ਏਜੰਸੀਂ ਤੋਂ ਗੱਲ ਕਰ ਰਹੇ ਹਾਂ ਮੇਰੇ ਕੋਲ ਸਰ ਇੱਕ ਸਵਿਫਟ ਖੜ੍ਹੀ ਹੈ ਇੱਕ ਆਪਣੀ ਇੰਡਿਕਾ ਖੜ੍ਹੀ ਹੈ ਇੱਕ ਆਪਣਾ ਅਲੈਗਜ਼ਾ ਖੜ੍ਹੀ ਹੈ ਟੋਇਟਾ ਆਲਿਆ ਦੀ ਇਕ ਸਫਾਰੀ ਖੜ੍ਹੀ ਹੈ ਜੀ ਤੁਹਾਨੂੰ ਇਹ ਚਾਰ ਦੀਆਂ ਚਾਰ ਗੱਡੀਆਂ ਨਿਊ ਦਿੱਲੀ ਨੰਬਰ ਖੜ੍ਹੀਆਂ ਦਿੱਲੀ ਨੰਬਰ ਦੀਆਂ ਹਾਂਜੀ ਤੁਹਾਨੂੰ ਕਿਹੜੀ ਗੱਡੀ ਚਾਹੀਦੀ ਹੈ ਅਤੇ ਕੀ ਕੌਸਟ ਹੈ ਰੇਂਜ ਕਿੰਨੀ ਹੈ ਤੁਹਾਡੀ ਸਰ ਗੱਡੀ ਬੈਸਟ ਹੋਣਗੀਆਂ ਸਾਡੀਆਂ ਅਤੇ ਫਿਰ ਤੁਸੀਂ ਗੱਡੀ ਲੈਣੀ ਕਿਹੜੀ ਚਾਹੋਗੇ ਪਹਿਲਾਂ ਦੱਸੋ ਤੁਸੀਂ ਉਸ ਹਿਸਾਬ ਨਾਲ਼ ਅਸੀਂ ਅੱਗੇ ਟੋਪਿਕ 'ਤੇ ਗੱਲ ਕਰਦੇ ਹਾਂ ਜੀ ਸਵਿਫਟ ਮਿਲਜੂ ਸਵਿਫਟ ਮੇਰੇ ਕੋਲ ਵਾਈਟ ਕਲਰ ਦੇ ਵਿੱਚ ਖੜੀ ਹੈ ਨੌ ਡੈਟਿੰਗ ਪੈਟਿੰਗ ਓਰੀਜਨਲ ਦੋ ਹਜ਼ਾਰ ਦਸ ਮੌਡਲ ਅਤੇ ਆਪਣਾ ਸਾਰੇ ਕਾਗਜ਼ ਪੱਤਰ ਓਕੇ ਹਾਂਜੀ ਉਹਦੀ ਦੋ ਲੱਖ ਪੈਂਤੀ ਹਜ਼ਾਰ ਰੁਪਇਆ ਰੇਂਜ ਹੈ ਦੋ ਦੋ ਲੱਖ ਪੈਂਤੀ ਹਜ਼ਾਰ ਰੁਪਇਆ ਰੇਂਜ ਦੋ ਹਜ਼ਾਰ ਦਸ ਮੌਡਲ ਗੱਡੀ ਹੈ ਬਿਲਕੁਲ ਸਾਫ਼ ਹੈ ਇੰਜਣ ਐਨ ਓਕੇ ਕੋਈ ਕੰਮ ਕੁੰਮ ਨੀ ਹੋਇਆ ਪਿਆ ਹਾਂਜੀ ਭਾਜੀ ਓਕੇ ਜੀ

ਕੋਈ ਗੱਲ ਨੀ ਸਰ ਮੋਸਟ ਵੈਲਕਮ ਜਦ ਮਰਜ਼ੀ ਏਜੰਸੀ ਆਓ ਗ੍ਰਾਹਕਾਂ ਲਈ ਮੋਸਟ ਵੈਲਕਮ ਠੀਕ ਹੈ ਸਰ ਥੈਂਕ ਯੂ ਸੋ ਮੱਚ ਸਾਡੇ ਰੋਪੜ ਏਜੰਸੀ 'ਚ ਕੋਲ ਕਰਨ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ